ਆਮ ਤੌਰ 'ਤੇ ਮੈਂ ਦੁਪਹਿਰ ਦੇ ਖਾਣੇ ਵਿੱਚ ਚਾਵਲ ਦਾਲ਼ ਜਾਂ ਸਬਜ਼ੀ ਔਰ ਰੋਟੀ ਪਕਾਉਣਾ ਪਸੰਦ ਕਰਦੀ ਹਾਂ ਕਿਉਂਕਿ ਮੇਰੇ ਪਰਿਵਾਰ ਨੂੰ ਇਹ ਚੀਜ਼ਾਂ ਖਾਣੀਆਂ ਦੁਪਹਿਰ ਦੇ ਖਾਣੇ ਵਿੱਚ ਵਧੀਆ ਲੱਗਦੀਆਂ ਅਤੇ ਰਾਤ ਦੇ ਵੇਲੇ ਅਸੀਂ ਹਲਕਾ ਖਾਣਾ ਖਾਂਦੇ ਹਾਂ ਖਿਚੜੀ ਹੋ ਗਿਆ ਯਾ ਫਿਰ ਦਾਲ਼ ਹੋ ਗਈ ਯਾ ਰੋਟੀ ਹੋ ਗਈ ਬਸ ਇਹ ਚੀਜ਼ਾਂ ਅਸੀਂ ਰਾਤ ਦੇ ਖਾਣੇ ਵਿੱਚ ਬਣਾਉਂਦੇ ਹਾਂ